ਮੇਰੇ ਜ ਪਿਆਰੇ ਮਿੱਤਰੋ ਮੈਂ ਤੁਹਾਡੇ ਵਾਸਤੇ ਰਾਤ ਦਾ ਸ਼ੋ ਬੁੱਕ ਕਰਵਾ ਦਿੱਤਾ ਹੈ ਫਿਲਮ ਦਾ ਨਾਂ ਹੈ ਨਾਮ ਹੈ ਸਕਾਈ ਰੋਕ ਅਤੇ ਐਮ ਬੀ ਡੀ ਮਾਲ ਦੇ ਵਿੱਚ ਸਾਢੇ ਨੌਂ ਵਜੇ ਦਾ ਸ਼ੋ ਹੈ ਸਾਰੇ ਜਾਣੇ ਨੌਂ ਵਜੇ ਉੱਥੇ ਟਿਚ ਪਹੁੰਚ ਜਾਇਓ ਤਾਂ ਜੋ ਅਸੀਂ ਫਿਲਮ ਨੂੰ ਟਾਇਮ ਸਿਰ ਸ਼ੁਰੂ ਕਰ ਸਕੀਏ ਅਤੇ ਉੱਥੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਕੋਈ ਪਾਣੀ ਦੀ ਬੋਤਲ ਨਹੀਂ ਲੈ ਕੇ ਆਏਗਾ ਪਾਣੀ ਦੀ ਬੋਤਲ ਅੰਦਰ ਨਹੀਂ ਜਾਏਗੀ ਔਰ ਇਹ ਖਾਣ ਪੀਣ ਦਾ ਕੋਈ ਵੀ ਸਮਾਨ ਅੰਦਰ ਨਹੀਂ ਜਾਣਾ ਅਸੀਂ ਫਿਲਮ ਵੇਖਣ ਤੋਂ ਬਾਅਦ ਬਾਹਰ ਕੁਛ ਖਾ ਪੀ ਲਵਾਂਗੇ ਜਿੱਦਾਂ ਸਾਡੇ ਸਾਰਿਆਂ ਦੀ ਸਲਾਹ ਹੋਏਗੀ ਇਸ ਕਰਕੇ ਤੁਸੀਂ ਆਪਣੇ ਘਰ ਵਿੱਚ ਸਾਰੇ ਦੱਸ ਕੇ ਆਇਓ ਅਸੀਂ ਬਾਰ੍ਹਾਂ ਵੱਜ ਕਿ ਸਾਨੂੰ ਘਰ ਪਹੁੰਚਦਿਆਂ ਹੋਇਆਂ ਬਾਰ੍ਹਾਂ ਵੱਜਣਗੇ ਅਤੇ ਫਿਲਮ ਬਹੁਤ ਹੀ ਵਧੀਆ ਹੈ ਮੇਰੇ ਪਿਆਰੇ ਮਿੱਤਰੋ ਕੋਈ ਵੀ ਸੀਨ ਮਿਸ ਨਾ ਕਰਨਾ ਸਾਰੇ ਟਾਈਮ ਤੋਂ ਪਹਿਲੇ ਪਹੁੰਚਣਾ ਟਾਈਮ ਤੋਂ ਪਹਿਲੇ ਚ ਅਗਰ ਅਸੀਂ ਫਿਲਮ ਤੋਂ ਪਹਿਲੇ ਪਹੁੰਚ ਜਾਵਾਂਗੇ ਤਾਂ ਅਸੀਂ ਮਾਲ ਦੇ ਵਿੱਚ ਘੁੰਮ ਲਵਾਂਗੇ ਅਤੇ ਵਿੰਡੋ ਸ਼ੋਪਿੰਗ ਕਰ ਲਵਾਂਗੇ ਅਤੇ ਸਾਰੇ ਟਾਈਮ ਸਿਰ ਪਹੁੰਚ ਜਾਣਾ